ਹੈਲੋ ਸਰ ਸਤਿ ਸ਼੍ਰੀ ਅਕਾਲ ਸਰ ਮੈਂ ਉਪਾਸਨਾ ਸਰ ਮੈਂ ਕੱਲ੍ਹ ਤੁਹਾਡੀ ਕੈਬ ਬੁੱਕ ਕੀਤੀ ਸੀ ਇਸ ਨੰਬਰ 'ਤੇ ਅਤੇ ਮੈਂ ਪੁੱਛਣਾ ਸੀ ਅਰਬਨ ਸਟੇਟ ਫੇਸ ਵਨ ਨੌ ਵਜੇ ਤੱਕ ਪਹੁੰਚ ਜੂੰਗੀ ਕਿਉਂਕਿ ਸਰ ਪਿਛਲੀ ਵਾਰ ਮੇਰੀ ਨਾ ਤੁਹਾਡੀ ਕੈਬ ਲੇਟ ਹੋਣ ਕਾਰਨ ਮੇਰੀ ਮੀਟਿੰਗ ਮਿਸ ਹੋ ਗਈ ਸੀ ਤਾਂ ਇਸ ਕਰਕੇ ਮੈਂ ਤੁਹਾਡੀ ਇਸ ਕੈਬ ਤੋਂ ਸੈਟਿਸਫਾਈ ਨਹੀਂ ਸੀ ਤਾਂ ਮੈਨੂੰ ਐਵੇਂ ਸੀ ਕਿ ਜੇ ਟਾਈਮ 'ਤੇ ਪਹੁੰਚੂਗੀ ਤਾਂ ਦੇਖੋ ਮੈਂ ਮੀਟਿੰਗ ਅਟੈਂਡ ਕਰ ਸਕਦੀ ਹਾਂ ਜੇ ਟਾਈਮ 'ਤੇ ਨਹੀਂ ਪਹੁੰਚੂਗੀ ਤਾਂ ਮੇਰੀ ਮੀਟਿੰਗ ਕੈਂਸਲ ਹੋਜੂਗੀ ਸਰ ਪਲੀਜ਼ ਨੌ ਵਜੇ ਤੱਕ ਇਹਨਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਨਾ ਕਿਉਂਕਿ ਇਹਦੇ ਨਾਲ ਆਪਣੇ ਅਰਜੈਂਟ ਕੰਮ ਪੂਰੇ ਹੋ ਜਾਂਦੇ ਨੇ ਅਤੇ ਮੈਂ ਆਸ ਕਰਦੀ ਹਾਂ ਕਿ ਅੱਗੇ ਤੋਂ ਵੀ ਤੁਹਾਡੀ ਇਹ ਵੀ ਕੋਈ ਪ੍ਰੋਬਲਮ ਨਾ ਆਵੇ ਤਾਂ ਜੋ ਬੰਦਾ ਕੋਈ ਵੀ ਹੈ ਆਪਣੇ ਟਾਈਮ 'ਤੇ ਜਾ ਕੇ ਆਪਣੀ ਮੀ ਮੀਟਿੰਗ ਨੂੰ ਅਟੈਂਡ ਕਰ ਸਕੇ